ਹੈਲੋ ਕਟਾਣੀ ਢਾਬੇ ਤੋਂ ਬੋਲਦੇ ਸਤਿ ਸ਼੍ਰੀ ਅਕਾਲਜੀ ਮੈਂ ਨਾ ਮੋਹਾਲੀ ਤੋਂ ਬੋਲਦਾ ਜਸਪਾਲ ਸਿੰਘ ਢਿੱਲੋ ਮੈਂ ਲਗਭਗ ਦੋ ਘੰਟੇ ਪਹਿਲਾਂ ਤੁਹਾਨੂੰ ਇੱਕ ਔਡਰ ਬੁੱਕ ਕਰਾਇਆ ਸੀ ਜਿਹਦੇ ਵਿੱਚ ਰੋਟੀਆਂ ਨਾਹਨ ਦਾਲ਼ ਮੱਖਣੀ ਸ਼ਾਹੀ ਪਨੀਰ ਕੜਾਹੀ ਪਨੀਰ ਪਨੀਰ ਦੀ ਭੁਰਜੀ ਚਾਵਲ ਰੇਇਤਾ ਮਿੱਸੀਆਂ ਰੋਟੀਆਂ ਗੁਲਾਬ ਜਾਮਣ ਆਈਸ ਕ੍ਰੀਮ ਰਸਗੁੱਲਾ ਇਹ ਮੈਂ ਬੁੱਕ ਕਰਾਇਆ ਸੀ ਅਤੇ ਪੈਸੇ ਵੀ ਔਨਲਾਈਨ ਤੁਹਾਡੇ ਖਾਤੇ ਵਿੱਚ ਪਾ ਦਿੱਤੇ ਸੀ ਅਤੇ ਹੁਣ ਪ੍ਰੋਬਲਮ ਇਹ ਆ ਗਈ ਵੀ ਮੈਨੂੰ ਕੋਈ ਜ਼ਰੂਰੀ ਕਿਤੇ ਜਾਣਾ ਪੈ ਗਿਆ ਇਹਦੇ ਕਰਕੇ ਜੇ ਮੈਂ ਜਿਹੜਾ ਔਡਰ ਹੈ ਮੇਰਾ ਇਹ ਕੈਂਸਲ ਕਰ ਦਿਓ ਜਿਹੜੇ ਮੇਰੇ ਪੈਸੇ ਐਂ ਜਾਂ ਤਾਂ ਕਿਸੇ ਆਪਣੇ ਕਿਸੇ ਬੰਦੇ ਥਰੂ ਮੇਰੇ ਘਰ ਭੇਜ ਦਿਓ ਜਾਂ ਫਿਰ ਆਪਣਾ ਔ ਔਫਲਾਈਨ ਕਰ ਦਿਓ ਜਾਂ ਮੇਰੇ ਖਾਤੇ ਵਿੱਚ ਆ ਜਾਣ ਤੁਹਾਡਾ ਬਹੁਤ ਬਹੁਤ ਧੰਨਵਾਦ